ਇਹ ਬਿਲਕੁਲ ਠੀਕ ਹੈ ਕਿ ਯੋਗਾ ਕਰਨ ਨਾਲ ਪੁਰਾਣੀ ਤੋਂ ਪੁਰਾਣੀ ਬਿਮਾਰੀ ਅਤੇ ਦਰਦ ਨੂੰ ਠੀਕ ਕਰ ਦਿੱਤਾ ਜਾਂਦਾ ਹੈ ਅੱਜ ਦੇ ਵਕਤ ਵਿੱਚ ਯੋਗ ਬੜਾ ਪ੍ਰਚਲਿਤ ਹੈ ਹੋ ਚੁੱਕਾ ਹੈ ਸਾਡੀ ਦਿਨ ਦੀ ਸ਼ੁਰੂਆਤ ਯੋਗਾ ਸਰੀਰਕ ਕਿਰਿਆਵਾਂ ਦੁਆਰਾ ਹੀ ਕੀਤੀ ਜਾਂਦੀ ਹੈ ਤਾਂ ਕਿ ਸਰੀਰ ਹਮੇਸ਼ਾ ਨਿਰੋਗ ਅਤੇ ਸਿਹਤਮੰਦ ਰਹੇ ਮੈਂ ਹਰ ਰੋਜ਼ ਯੋਗਾ ਦਾ ਅਭਿਆਸ ਕਰਨ ਲਈ ਆਪਣੇ ਘਰ ਤੋਂ ਥੋੜ੍ਹੀ ਦੂਰ ਜਾਂਦੀ ਹਾਂ ਮੈਂ ਦੇਖਦੀ ਹਾਂ ਕਿ ਹਰ ਇੱਕ ਜਨਾ ਯੋਗ ਦੀ ਕਲਾਸ ਵਿੱਚ ਬਹੁਤ ਖੁਸ਼ ਲੱਗਦਾ ਹੈ ਕਿਉਂਕਿ ਉਹ ਇੱਕ ਡੇਢ ਘੰਟਾ ਸਾਨੂੰ ਕਾਫੀ ਤੰਦਰੁਸਤ ਬਣਾ ਦਿੰਦਾ ਹੈ ਅਤੇ ਸਾਨੂੰ ਇੱਕ ਚੰਗਾ ਮਹਿਸੂਸ ਕਰਵਾਉਂਦਾ ਹੈ ਮੇਰੇ ਪਹਿਚਾਨਣ ਵਾਲੇ ਤਾਂ ਕਈ ਲੰ ਕਈ ਸਾਲ ਲੰਬੀ ਬਿਮਾਰੀਆਂ ਤੋਂ ਰਾਹਤ ਪਾ ਚੁੱਕੇ ਹਨ ਅਤੇ ਰਾਹਤ ਪਾ ਚੁੱਕੇ ਹਨ ਯੋਗ ਸਾਨੂੰ ਮਨ ਅਤੇ ਤਨ ਦੋਨਾਂ ਨੂੰ ਤੰਦਰੁਸਤ ਰੱਖਦਾ ਹੈ ਯੋਗ ਰੋਜ਼ਾਨਾ ਕਰਨ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ ਯੋਗ ਸਾਡੇ ਦਿਮਾਗ ਨੂੰ ਤੰਦਰੁਸਤ ਰੱਖਦਾ ਹੈ ਰੋਜ਼ਾਨਾ ਮੈਡੀਟੇਸ਼ਨ ਕਰਨ ਨਾਲ ਸਾਡਾ ਦਿਮਾਗ ਤੰਦਰੁਸਤ ਰਹਿੰਦਾ ਹੈ ਅਤੇ ਸਾਡੀ ਸੋਚ ਵਿੱਚ ਬਹੁਤ ਪੋਜੀਟਿਵਿਟੀ ਆਉਂਦੀ ਹੈ ਜਿਸ ਅਸੀਂ ਚੰਗਾ ਸੋਚਦੇ ਹਾਂ ਅਤੇ ਮਨ ਨੂੰ ਸ਼ਾਂਤ ਰੱਖਦੇ ਹਾਂ ਅੱਜ ਦੇ ਟਾਈਮ ਵਿੱਚ ਜਵਾਨ ਨੌਜਵਾਨ ਦਿਮਾਗੀ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਪਰ ਯੋਗ ਰਾਹੀਂ ਇਹ ਬਿਮਾਰੀਆਂ ਨੂੰ ਵੀ ਖ਼ਤਮ ਕਰ ਦਿੱਤਾ ਜਾ ਰਿਹਾ ਹੈ ਯੋਗ ਸਾਡੀ ਸਿਹਤ ਦਾ ਮਦਦਗਾਰ ਇਕ ਚੰਗਾ ਅਤੇ ਵਧੀਆ ਸਰੋਤ ਹੈ